ਹੈਲੋ ਨਮਸਤੇ ਜੀ ਮੈਂ ਸੀਮਾ ਦੇਵੀ ਸੁਜਾਨਪੁਰ ਤੋਂ ਬੋਲਦੀ ਹਾਂ ਹਾਂਜੀ ਤਿਉਹਾਰਾਂ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਜਿੱਦਾਂ ਮਤਲਬ ਕਿ ਅਸੀਂ ਕੋਈ ਤਿਉਹਾਰ ਹੋਏ ਤਾਂ ਬੜੇ ਉਤਸ਼ਾਹ ਚਾਵਾਂ ਨਾਲ ਮਨਾਉਂਦੇ ਹਾਂ ਜਿੱਦਾਂ ਮਤਲਬ ਕਿ ਦਿਵਾਲੀ ਦਾ ਤਿਉਹਾਰ ਹੋ ਗਿਆ ਵਿਸਾਖੀ ਦਾ ਹੋ ਗਿਆ ਮਤਲਬ ਕਿ ਬਸੰਤ ਦਾ ਹੋ ਗਿਆ ਜਿੱਦਾਂ ਅਤੇ ਕੋਈ ਤਿਉਹਾਰ ਹੋਏ ਕਈ ਬੜੇ ਧੂਮਧਾਮ ਨਾਲ ਮਨਾਉਂਦੇ ਹਾਂ ਬੱਚਿਆਂ ਨੂੰ ਬੜਾ ਚਾਅ ਹੁੰਦਾ ਅਤੇ ਘਰ ਵਿੱਚ ਪਕੌੜੇ ਬਣਾਏ ਜਾਂਦੇ ਹਨ ਜਿੱਦਾਂ ਵੇਸਣ ਅਤੇ ਪਿਆਜ਼ ਵਗੈਰਾ ਆਲੂ ਵਗੈਰਾ ਮਿਕਸ ਕਰਕੇ ਪਕੌੜੇ ਬਣਾਏ ਜਾਂਦੇ ਹਨ ਜਲੇਬੀਆਂ ਬਣਾਉਂਦੇ ਹਾਂ ਕਿ ਬੱਚੇ ਬੜੇ ਖੁਸ਼ ਹੋ ਕੇ ਖਾ ਲੈਂਦੇ ਹੈ ਅਤੇ ਬਸੰਤ ਜਿੱਦਾਂ ਹੁੰਦੀ ਹੈ ਤਾਂ ਕੋਈ ਪੀਲੀ ਚੀਜ਼ ਬਣਾ ਲੈਂਦੇ ਹਾਂ ਅਤੇ ਬਣਾ ਕੇ ਖਾਂਦੇ ਹਾਂ ਅਤੇ ਤਾਂ ਵੀ ਇਹ ਬੜੇ ਉਤਸ਼ਾਹ ਨਾਲ ਹਰ ਚੀਜ਼ ਨੂੰ ਮਤਲਬ ਕਿ ਮੰਨੋਰੰਜਨ ਕਰਦੇ ਹਾਂ ਅਤੇ ਹੋਰ ਕਈ ਤਰ੍ਹਾਂ ਦੇ ਮੰਨੋਰੰਜਨ ਦੀਆਂ ਚੀਜ਼ਾਂ ਬਣਾ ਲੈਂਦੇ ਹਾਂ ਖਾਣ ਵਾਸਤੇ ਕਈ ਚੀਜ਼ਾਂ ਬਣਾ ਲੈਂਦੇ ਹਾਂ ਜਿੱਦਾਂ ਹਲਵਾ ਬਣਾ ਲਈ ਪੂਰੀਆਂ ਬਣਾ ਲਈਆਂ ਜਿੱਦਾਂ ਨਵਰਾਤਰਿਆਂ 'ਚ ਕੰਜਕਾਂ ਨੂੰ ਪੂਜਣਾ ਹੁੰਦਾ ਹੈ ਅਤੇ ਜਿੱਦਾਂ ਵੀ ਹਲਵਾ ਪੂਰੀ ਅਤੇ ਚਨੇ ਬਣਾ ਲਈਦੇ ਨੇ ਖਾਣ ਵਾਸਤੇ ਅਤੇ ਇੱਦਾਂ ਬੱਚੇ ਖੁਸ਼ ਹੋ ਕੇ ਖਾ ਵੀ ਲੈਂਦੇ ਨੇ ਹੋਰ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਜਿੱਦਾਂ ਕਿ ਤੁਸੀਂ ਆਪਣੇ ਘਰ ਵਿੱਚ ਘਰ ਵਿੱਚ ਹੋਰ ਵੀ ਕੋਈ ਮਾੜਾ ਮੋਟਾ ਪ੍ਰੋਗਰਾਮ ਕਰਨਾ ਹੋਏ ਤਾਂ ਹਲਵਾ ਪੂਰੀ ਤਾਂ ਬੜੇ ਚਾਵਾਂ ਨਾਲ ਬਣਾਏ ਜਾਂਦੇ ਆ ਤੁਹਾਨੂੰ ਪਤਾ ਕਿ ਹਲਵਾ ਕਿੱਦਾਂ ਬਣਾਉਂਦੇ ਆ ਕਿ ਜਿੱਦਾਂ ਘਿਓ ਵਿੱਚ ਸੂਜੀ ਨੂੰ ਭੁੰਨ ਦਿੱਤਾ ਜਾਂਦਾ ਹੈ ਅਤੇ ਫੇਰ ਉਹਦੇ 'ਚ ਪਾਣੀ ਪਾ ਕੇ ਚੀਨੀ ਪਾ ਕੇ ਅਤੇ ਹਲਵਾ ਬਣਾ ਬਣਾਉਂਦੇ ਹਾਂ ਅਤੇ ਇੱਦਾਂ ਹੀ ਪੂਰੀਆਂ ਜਿੱਦਾਂ ਮੈਦਾ ਔਰ ਮਤਲਬ ਕਿ ਆਟਾ ਗੇਂਹੂੰ ਦਾ ਮਿਕਸ ਕਰਕੇ ਅਤੇ ਜਿੱਦਾਂ ਮਤਲਬ ਮੈਸ਼ ਕਰਕੇ ਉਹਨਾਂ ਦੇ ਛੋਟੇ ਛੋਟੇ ਗੋਲ ਕਰਕੇ ਬਣਾ ਲੈਣੇ ਪੇੜੇ ਅਤੇ ਫੇਰ ਉਹਨਾਂ ਨੂੰ ਕੜਾਹੀ ਵਿੱਚ ਤੇਲ ਵਿੱਚ ਜਾਂ ਘ ਘਿ ਘਿਓ ਵਿੱਚ ਫਰਾਈ ਕਰ ਲਓ ਅਤੇ ਪੂਰੀਆਂ ਬਣ ਜਾਂਦੀਆਂ ਜਿੱਦਾਂ ਖਾਣ ਨੂੰ ਵੀ ਸਵਾਦ ਲੱਗਦੀਆਂ ਬੱਚਿਆਂ ਨੂੰ ਵੀ ਬੱਚੇ ਵੀ ਬੜੇ ਖੁਸ਼ ਹੋ ਕੇ ਖਾ ਲੈਂਦੇ ਹਨ ਧੰਨਵਾਦ